ਪਿੱਛਲੇ ਕੁਝ ਸਾਲਾਂ ਵਿੱਚ ਮਨੋਰੰਜਨ ਕਰਨ ਲਈ ਸਾਰੇ ਲੋਕ ਇਕੱਠੇ ਬੈਠਦੇ ਅਤੇ ਗਾਉਂਦੇ ਅਤੇ ਨੱਚਦੇ ਸਨ ਕਿਉਂਕਿ ਪਹਿਲਾਂ ਦੇ ਸਮੇਂ ਵਿੱਚ ਅੱਜ ਨਾਲੋਂ ਬਹੁਤ ਜ਼ਿਆਦਾ ਘੱਟ ਸਹੂਲਤਾਂ ਸਨ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਹੀ ਬੈਠ ਕੇ ਮਨੋਰੰਜਨ ਕਰਦੇ ਸਨ ਕਿਉਂਕਿ ਅੱਜ ਕੱਲ੍ਹ ਕੰਪਿਊਟਰ ਰੇਡੀਓ ਅਤੇ ਟੀ ਵੀ ਦੇ ਸਹਾਇਤਾ ਨਾਲ ਸਾਰੇ ਆਪਣੇ ਘਰ ਵਿੱਚ ਹੀ ਆਪਣਾ ਆਪਣਾ ਮਨੋਰੰਜਨ ਕਰਦੇ ਸਨ ਅਤੇ ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਵਿੱਚ ਵੀ ਬਹੁਤ ਘੱਟ ਘਟਾਈ ਹੋ ਗਈ ਹੈ ਅਤੇ ਮੇਲ ਮਿਲਾਪ ਵੀ ਬਹੁਤ ਜ਼ਿਆਦਾ ਘੱਟ ਚੁੱਕਿਆ ਹੈ ਜਿਸ ਕਰਕੇ ਸਾਰੇ ਆਪਣਾ ਹੀ ਵਿਅਸਤ ਰਹਿੰਦੇ ਸਨ